ਮੈਂ ਲੈਨੋਵੋ ਦਾ ਲੈਪਟੋਪ ਮੋਡਲ ਜ਼ੈਡ ਥਰਟੀ ਥਰੀ ਜੋ ਕਿ ਕੋਰ ਆਈ ਫਾਇਵ ਪ੍ਰੋਸੈਸਰ ਟਵੈਲਵਥ ਜਨਰੇਸ਼ਨ ਦੇ ਨਾਲ ਆ ਰਿਹਾ ਹੈ ਉਹ ਐਮਾਜ਼ੋਨ ਤੋਂ ਔਰਡਰ ਕੀਤਾ ਸੀ ਜਿਸ ਦੀ ਡਿਲੀਵਰੀ ਮੈਨੂੰ ਅੱਜ ਹੀ ਮਿਲੀ ਹੈ ਅਤੇ ਮੈਂ ਬਹੁਤ ਖੁਸ਼ ਹਾਂ ਕਿ ਇੱਕ ਤਾਂ ਬਿਲਕੁਲ ਸਹੀ ਹਾਲਤ ਵਿੱਚ ਡਿਲੀਵਰੀ ਮਿਲੀ ਹੈ ਅਤੇ ਖਾਸ ਗੱਲ ਹੈ ਕਿ ਇਸ ਦੇ ਨਾਲ ਇਕੱਲਾ ਲੈਪਟੋਪ ਨਹੀਂ ਲੈਪਟੋਪ ਦਾ ਬੈਗ ਵੀ ਅਤੇ ਇੱਕ ਵਾਇਰਲੈਸ ਮਾਊਸ ਵੀ ਉਹ ਵੀ ਲੈਨੋਵੋ ਕੰਪਨੀ ਦਾ ਔਰਿਜਨਲ ਨਾਲ ਦਿੱਤਾ ਗਿਆ ਹੈ ਜਿਹੜਾ ਕਿ ਫਰੀ ਔਫ ਕੋਸ਼ਟ ਹੈ ਇਸਦੀ ਖਾਸੀਅਤ ਹੈ ਕਿ ਇਹ ਜਿਹੜਾ ਲੈਪਟੋਪ ਹੈ ਅੱਠ ਜੀ ਬੀ ਰੈਮ ਅਤੇ ਨਾਲ ਇੱਕ ਇੱਕ ਟੀ ਬੀ ਐਸ ਐਸ ਡੀ ਹਾਰਡ ਡਿਸਕ ਦੇ ਨਾਲ ਆ ਰਿਹਾ ਹੈ ਅਤੇ ਸਭ ਤੋਂ ਖਾਸ ਗੱਲ ਕਿ ਜਿਹੜਾ ਮੇਰਾ ਪੁਰਾਣਾ ਲੈਪਟੋਪ ਸੀ ਜਿਹਦੇ ਵਿੱਚ ਹਾਰਡ ਡਿਸਕ ਹੁੰਦੀ ਸੀ ਉਹ ਲੈਪਟੋਪ ਔਨ ਹੋਣ 'ਤੇ ਲਗਭਗ ਦੋ ਮਿੰਟ ਲਗਾ ਦਿੰਦਾ ਸੀ ਇਹ ਲੈਪਟੋਪ ਸਿਰਫ ਇੱਕ ਬਟਨ ਦੇ ਨਾਲ ਕਲਿੱਕ ਕਰਨ 'ਤੇ ਅਤੇ ਇੱਕ ਫਿੰਗਰ ਪ੍ਰਿੰਟ ਸੈਂਸਰ ਦਿੱਤਾ ਗਿਆ ਹੈ ਅਤੇ ਫਿੰਗਰ ਪ੍ਰਿੰਟ ਲਾਉਂਦੇ ਹੀ ਜਿਸ ਤਰੀਕੇ ਨਾਲ ਫੋਨ ਔਨ ਹੁੰਦਾ ਹੈ ਉਸ ਤਰੀਕੇ ਨਾਲ ਲੈਪਟੋਪ ਔਨ ਹੋ ਜਾਂਦਾ ਹੈ ਅਤੇ ਸਭ ਤੋਂ ਖਾਸ ਗੱਲ ਹੈ ਕਿ ਇਹਦੇ ਵਿੱਚ ਵਿੰਡੋਜ਼ ਟੈਂਨ ਔਰਿਜਨਲ ਨਾਲ ਦਿੱਤੀ ਗਈ ਹੈ ਅਤੇ ਜਿਸਦਾ ਇਹਨੂੰ ਅੱਪਗ੍ਰੇਡ ਵੀ ਕਰ ਸਕਦੇ ਹਾਂ ਅਤੇ ਮਾਈਕਰੋਸੋਫਟ ਦਾ ਔਫਿਸ ਟੂ ਥਾਉਸੈਂਡ ਟਵੰਟੀ ਵਨ ਉਹ ਵੀ ਬਿਲਕੁਲ ਫਰੀ ਨਾਲ ਦਿੱਤਾ ਗਿਆ ਹੈ ਮੈਂ ਬਾਜ਼ਾਰ ਵਿੱਚ ਪਹਿਲਾਂ ਘੁੰਮਿਆ ਸੀ ਅਤੇ ਇਹ ਸੇਮ ਲੈਪਟੋਪ ਬੜੇ ਹੀ ਸਿਫਾਰਸ਼ਾਂ ਲਗਾ ਕੇ ਬਵੰਜ਼ਾ ਹਜ਼ਾਰ ਤੋਂ ਥੱਲੇ ਨਹੀਂ ਸੀ ਮਿਲ ਰਿਹਾ ਪਰ ਮੈਨੂੰ ਇਹ ਲੈਪਟੋਪ ਔਨਲਾਈਨ ਔਡਰ ਕਰਨ 'ਤੇ ਸਿਰਫ ਪੰਤਾਲੀ ਹਜ਼ਾਰ ਪੰਜ ਸੌ ਰੁਪਏ ਦੇ ਵਿੱਚ ਮਿਲ ਗਿਆ ਹੈ ਜਿਹਦੇ ਵਿੱਚ ਮੈਨੂੰ ਇਹ ਸਮਝ ਲੱਗਦੀ ਹੈ ਕਿ ਮੈਂ ਲਗਭਗ ਆਪਣਾ ਸੱਤ ਹਜ਼ਾਰ ਰੁਪਇਆ ਜਿਹੜਾ ਉਹ ਬਚਾ ਲਿਆ ਅਤੇ ਮੈਂ ਇਸ ਪ੍ਰੋਡਕਟ ਤੋਂ ਬਹੁਤ ਖੁਸ਼ ਹਾਂ ਅਤੇ ਇਹ ਵੀ ਖੁਸ਼ੀ ਵਾਲੀ ਗੱਲ ਹੈ ਕਿ ਇਸਦੇ ਨਾਲ ਗਰੰਟੀ ਵੀ ਜਿਹੜੀ ਹੈ ਉਹ ਨਾਲ ਮਿਲ ਰਹੀ ਹੈ ਨਹੀਂ ਤਾਂ ਔਨਲਾਈਨ ਪ੍ਰੋਡਕਟ ਦੀ ਗਰੰਟੀ ਨਹੀਂ ਆਉਂਦੀ ਗਰੰਟੀ ਕਾਰਡ ਨਾਲ ਦਿੱਤਾ ਗਿਆ ਅਤੇ ਮੈਂ ਉਹ ਗਰੰਟੀ ਵਾਸਤੇ ਰਜਿਸਟਰ ਵੀ ਕਰ ਲਿਆ ਅਤੇ ਗੇਮਿੰਗ ਵਾਸਤੇ ਇਹਦੇ ਵਿੱਚ ਨਵੀਡੀਆ ਦਾ ਗ੍ਰਾਫਿਕ ਕਾਰਡ ਵੀ ਜਿਹੜਾ ਉਹ ਅਡੀਸ਼ਨਲ ਲੱਗਾ ਹੋਇਆ ਜਿਹੜਾ ਕਿ ਬਹੁਤ ਹੀ ਫਾਇਦੇਮੰਦ ਹੈ ਧੰਨਵਾਦ ਜੀ